ਮੈਂ ਔਨਲਾਈਨ ਸ਼ੋਪਿੰਗ ਦੇਖੀ ਸੀ ਉਹਦੇ 'ਤੇ ਬਿਊਟੀ ਪ੍ਰੋਡਕਟਸ 'ਤੇ ਔਫਰ ਲੱਗੀ ਹੋਈ ਸੀ ਮੈਨੂੰ ਬਿਊਟੀ ਦਾ ਸ਼ੌਂਕ ਹੈ ਅਤੇ ਮੈਨੂੰ ਸਕਿੰਨ ਕਰਨ ਕੇ ਕਰਨਾ ਚੰਗਾ ਲੱਗਦਾ ਹੈ ਮੈਂ ਉਹ ਪ੍ਰੋਡਕਟਸ ਖਰੀਦ ਲਏ ਪਰ ਉਨ੍ਹਾਂ ਦੇ ਰਿਵਿਊ ਜੋ ਕਿ ਔਨਲਾਈਨ ਬਹੁਤ ਵਧੀਆ ਦਿੱਤੇ ਸੀ ਪਰ ਉਹ ਗੱਲ ਨਹੀਂ ਸੀ ਉਹ ਮੇਰੀ ਸਕਿੰਨ ਨੂੰ ਸੂਟ ਨਹੀਂ ਕੀਤੇ ਜਾਂ ਹੋ ਸਕਦਾ ਹੈ ਬਾਕੀਆਂ ਦੀ ਸਕਿੰਨ ਨੂੰ ਸੂਟ ਕਰ ਗਏ ਹੋਣ ਪਰ ਮੇਰੀ ਸਕਿੰਨ ਨੂੰ ਸੋ ਸੂਟ ਨਹੀਂ ਕੀਤੇ ਕਿਉਂਕਿ ਮੇਰੀ ਸਕਿੰਨ ਸੋਫਟ ਹੈ ਮੇਰੀ ਸਕਿੰਨ ਨੂੰ ਇਹ ਰੈਸ਼ਿਸ਼ ਕਰ ਗਏ ਅਤੇ ਈਚਿਸ ਹੋ ਰਹੀਆਂ ਹਨ ਮੈਂ ਅੱਗੇ ਤੋਂ ਔਨਲਾਈਨ ਸ਼ੋਪਿੰਗ ਨਹੀਂ ਕਰੂ ਆਪਣੇ ਲਾਗੇ ਵਾਲੀ ਮਾਰਕੀਟ ਵਿੱਚ ਜਾਊਂ ਅਤੇ ਉੱਥੋਂ ਵਧੀਆ ਅ ਕਰੀਮ ਵਗੈਰਾ ਸਕਿੰਨ ਕੇਅਰ ਕਰਨ ਲਈ ਪ੍ਰੋਡਕਟਸ ਚੂਸ ਕਰੂੰ ਮੇਰੀ ਸਕਿੰਨ ਨੂੰ ਗਾਨੀਅਰ ਦੇ ਪ੍ਰੋਡਕਟਸ ਸੂਟ ਕਰਦੇ ਹਨ ਮੈਨੂੰ ਵਧੀਆ ਲੱਗਦੇ ਹਨ ਗਾਨੀਅਰ ਦੇ ਪ੍ਰੋਡਕਟਸ